ਹਾਂਜੀ ਮੈਂ ਤਾਂ ਇਹ ਹੀ ਸੁਝਾਅ ਦੇਣਾ ਚਾਹੁੰਦੀ ਹਾਂ ਕਿ ਪੰਛੀ ਜਿਨ੍ਹਾਂ ਦੇ ਪੰਛੀ ਰੱਖੇ ਹੋਏ ਨੇਗੇ ਕਿਉਂਕਿ ਵਧੀਆ ਸੇਵਾ ਕਰਨੀ ਚਾਹੀਦੀ ਹੈ ਬਾਕੀ ਸੱਟ ਲੱਗੀ 'ਤੇ ਜਾਂ ਕੋਈ ਫਰ ਕੱਟਣ ਵੱਢਣ 'ਤੇ ਉਹਦੇ ਦਵਾਈ ਲਗਾਉਣੀ ਚਾਹੀਦੀ ਹੈ ਅਤੇ ਬਾਕੀ ਜੇ ਵੇਖ ਪੰਛੀ ਰੱਖਣੇ ਬਹੁਤ ਵਧੀਆ ਗੱਲ ਆ ਮਤਲਬ ਆਲ੍ਣੇ ਬਣਾ ਕੇ ਰੱਖਣੇ ਚਾਹੀਦੇ ਨੇ ਪਾਣੀ ਦਾਣਾ ਪਾਣੀ ਐਨ ਉਹਨਾਂ ਨੂੰ ਦੋ ਪ੍ਰੋਪਰੀ ਅਤੇ ਮਤਲਬ ਉਹਨਾਂ ਦੇ ਵੇਖ ਦਵਾਈ ਬੂਟੀ ਵੀ ਦੇਣੀ ਚਾਹੀਦੀ ਹੈ ਬਾਕੀ ਦੇ ਜਿਹੜੇ ਜਿਹੜੇ ਕੋਈ ਰੱਖਦੇ ਨੇ ਵੀ ਉਹ ਵਧੀਆ ਬਹੁਤ ਵਧ ਵਧੀਆ ਗੱਲ ਆ ਮਤਲਬ ਉਹਦੀ ਸੇਵਾ ਕਰਦੇ ਨੇਗੇ ਚੱਲੋ ਵੀ ਇਹ ਵੀ ਇਹ ਵੀ ਇੱਕ ਬਹੁਤ ਚੰਗੀ ਗੱਲ ਹੈ